ਮੈਂ ਰਾਮਦਾਸ ਪਿੰਡ ਨਵਾਂ ਗਰਾਂ ਡਾਕਖਾਨਾ ਸਜਾਨਪੁਰ ਤਹਿਸੀਲ ਅਤੇ ਜ਼ਿਲ੍ਹਾ ਪਠਾਨਕੋਟ ਦਾ ਰਹਿਣਾ ਵਾਲਾ ਅਤੇ ਮੈਨੂੰ ਪਤਾ ਲੱਗਾ ਕਿ ਮੇਰੇ ਨਾਲ ਦੇ ਜਿਹੜੇ ਕੁਲੀਗ ਅਧਿਆਪਕ ਸ੍ਰੀ ਰਾਜੇਸ਼ ਕੁਮਾਰ ਹੋਣਾ ਦਾ ਬੇਟਾ ਵੀ ਚਿੱਤਰਕਾਰੀ ਵਿੱਚ ਸ਼ੌਕ ਰੱਖਦਾ ਅਤੇ ਉਹਨੂੰ ਮੈਂ ਇਹ ਸਲਾਹ ਦੇਵਾਂਗਾ ਕਿ ਚਿੱਤਰਕਾਰੀ ਇੱਕ ਬੜੀ ਵਧੀਆ ਚੀਜ਼ ਹੈ ਇਹਦੇ ਨਾਲ ਬੜੇ ਫਾਇਦੇ ਹੁੰਦੇ ਹਨ ਸਿਹਤ ਨਾਲ ਸੰਬੰਧਿਤ ਵੀ ਅਤੇ ਰੂਹ ਨਾਲ ਸੰਬੰਧਿਤ ਵੀ ਦੇਖੋ ਜਦੋਂ ਕੋਈ ਚਿੱਤਰਕਾਰ ਕੋਈ ਚਿੱਤਰ ਸਿਰਜਦਾ ਤਾਂ ਉਹਦੇ ਨਾਲ ਉਹਦੀ ਇੱਕ ਮਾਨਸਿਕ ਖੁਸ਼ੀ ਮਿਲਦੀ ਹੈ ਰੂਹਾਨੀ ਖੁਸ਼ੀ ਮਿਲਦੀ ਹੈ ਜਿਹਦੇ ਨਾਲ ਉਹਦੇ ਜਿਹੜੇ ਰਕਤ ਵਹਿਣੀਆਂ ਦਾ ਸੰਚਾਰ ਬੜਾ ਵਧੀਆ ਹੁੰਦਾ ਅਤੇ ਇੱਕ ਤਾਂ ਉਹਦੇ ਵਿਹਲੇ ਸਮੇਂ ਦੀ ਸਹੀ ਵਰਤੋਂ ਹੋ ਜਾਂਦੀ ਹੈ ਅਤੇ ਇੱਕ ਹੁਨਰ ਜਿਹਾ ਆ ਜਾਂਦਾ ਤੁਹਾਨੂੰ ਪਤਾ ਕਿ ਸ਼ੋਭਾ ਸਿੰਘ ਇੱਕ ਬੜਾ ਮਹਾਨ ਚਿੱਤਰਕਾਰ ਹੋਇਆ ਹੈ ਇਸ ਤਰ੍ਹਾਂ ਸੰਸਾਰ ਭਰ ਦੇ ਬਹੁਤ ਸਾਰੇ ਚਿੱਤਰਕਾਰ ਹੋਏ ਹਨ ਜਿਨ੍ਹਾਂ ਨੇ ਆਪਣੀ ਚਿੱਤਰਕਾਰੀ ਦਾ ਲੋਹਾ ਮਨਵਾਇਆ ਹੈ ਅਤੇ ਅਸੀਂ ਪੰਜਾਬ ਦੀ ਗੱਲ ਕਰੀਏ ਕਿ ਸ਼ੋਭਾ ਸਿੰਘ ਇੱਕ ਬੜਾ ਮਹਾਨ ਚਿੱਤਰਕਾਰ ਸੀ ਉਹਦੇ ਬਾਰੇ ਇਹ ਗੱਲ ਹੈ ਕਿ ਉਹ ਜਦੋਂ ਛੋਟਾ ਹੁੰਦਾ ਸੀ ਤਾਂ ਇੱਕ ਚਾਕੂ ਦੇ ਨਾਲ ਤਸਵੀਰਾਂ ਵਾਹਿਆ ਕਰਦਾ ਸੀ ਅਤੇ ਉਹ ਹੌਲੀ ਹੌਲੀ ਕਰਕੇ ਉਹਦੇ ਚਿੱਤਰਕਾਰ ਦੇ ਵਿੱਚ ਇੰਨਾ ਨਿਖਾਰ ਆ ਗਿਆ ਕਿ ਉਹਨੇ ਬੜੀਆਂ ਮਹਾਨ ਚਿੱਤਰਕਾਰੀ ਦੀ ਨਾਲ ਸੰਬੰਧਿਤ ਤਸਵੀਰਾਂ ਬਣਾਈਆਂ ਜਿਨ੍ਹਾਂ ਦੇ ਵਿੱਚੋਂ ਸੋਹਣੀ ਮਾ ਮਹੀਵਾਲ ਦਾ ਚਿੱਤਰ ਉਹਨਾਂ ਦਾ ਬਹੁਤ ਵਧੀਆ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਹੁਣੇ ਹੀ ਬੋਲ ਪਏ ਇਸ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਚਿੱਤਰ ਹੈ ਉਹ ਵੀ ਬਹੁਤ ਵਧੀਆ ਹੈ ਇਸ ਤਰ੍ਹਾਂ ਇੱਕ ਸੱਭਿਆਚਾਰਕ ਚਿੱਤਰ ਬਹੁਤ ਸਾਰਾ ਬਣ ਬਹੁਤ ਸਾਰੇ ਉਹਨਾਂ ਨੇ ਬਣਾਏ ਹਨ ਜਿਹੜੀ ਇੱਕ ਲਾਮਿਸ਼ਾਲ ਹੈ ਅਤੇ ਤੁਸੀਂ ਵੀ ਉਹਨਾਂ ਦੀ ਜਿਹੜੀ ਹੈ ਚਿੱਤਰਕਾਰੀ ਤੋਂ ਪ੍ਰੇਰਨਾ ਲੈ ਕੇ ਵਧੀਆ ਚਿੱਤਰ ਬਣਾ ਸਕਦੇ ਅਤੇ ਆਪਣੇ ਹੁਨਰ ਦਾ ਨਿਖਾਰ ਕਰ ਸਕਦੇ ਹੋ